ਹਾਂ ਮੈਂ ਦਰਅਸਲ ਵਿਗਿਆਨ ਨਾਲ ਜੁੜੀਆਂ ਕਿਤਾਬਾਂ ਪੜ੍ਹਨੀਆਂ ਪਸੰਦ ਕਰਦਾ ਹਾਂ ਮੈਂ ਵਿਗਿਆਨ ਦੇ ਕਈ ਕਿਤਾਬਾਂ ਨੂੰ ਪੜ੍ਹਿਆ ਹੈ ਅਤੇ ਮੈਂ ਦੇਖਿਆ ਹੈ ਕਿ ਉਹਨਾਂ ਵਿੱਚੋਂ ਮੇਰੀ ਕੁਝ ਮਨਪਸੰਦ ਹਨ ਜਿਵੇਂ ਕਿ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਜੀਵਨ ਧਰਤੀ ਉੱਤੇ ਕਿਸ ਪ੍ਰਕਾਰ ਉਪਜਿਆ ਕਿ ਇਹਨਾਂ ਕਿਤਾਬਾਂ ਵਿੱਚ ਇਹ ਦੱਸਿਆ ਗਿਆ ਕਿ ਜੀਵਨ ਧਰਤੀ ਉੱਤੇ ਇੱਕ ਛੋਟੇ ਜਿਹੇ ਜੀਵਾਣੂ ਦੇ ਰੂਪ ਵਿੱਚ ਉਪਜਿਆ ਉਸ ਜੀਵਾਣੂ ਨੇ ਹ ਹ ਹੌਲ਼ੀ ਹੌਲ਼ੀ ਆਪਣੇ ਆਪ ਨੂੰ ਹੋਰ ਵਧਾਇਆ ਹੋਰ ਸਿੱਖਿਆ ਅਤੇ ਹੋਰ ਉਹ ਵੱਧਦਾ ਵੱਧਦਾ ਗਿਆ ਇੱਕ ਹੋਰ ਗੁੰਝਲਦਾਰ ਜੀਵ ਦੇ ਵਿੱਚ ਬਦਲ ਗਿਆ ਉਹਦੇ ਗੁੰਝਲਦਾਰ ਜੀਵ ਦੇ ਵਿੱਚ ਹੋਰ ਤਬਦੀਲੀਆਂ ਆਉਂਦੀਆਂ ਗਈਆਂ ਉਹ ਆਪਣੇ ਵਾਤਾਵਰਨ ਤੋਂ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਗਿਆ ਉਹਦੇ ਨਵੇਂ ਨਵੇਂ ਚੀਜ਼ਾਂ ਸਿੱਖਣ ਦੇ ਨਾਲ ਉਸਦੇ ਕਈ ਹੋਰ ਬਰਾ ਵੱਖ ਵੱਖ ਰੂਪ ਤਿਆਰ ਹੋਏ ਉਹਨਾਂ ਵੱਖ ਵੱਖ ਰੂਪਾਂ ਤੋਂ ਹੀ ਅੱਜ ਦੇ ਜ਼ਮਾਨੇ ਦੇ ਕਈ ਸਾਰੇ ਜੀਵ ਜੰਤੂ ਹੋਂਦ ਵਿੱਚ ਆਏ